ਨਹੀਂ ਜੀ ਮੈਂ ਕਿਸੇ ਹੋਰ ਟ੍ਰੇਨਿੰਗ ਨਹੀਂ ਲਈ ਕੋਈ ਕਿਸੇ ਨੂੰ ਨਹੀਂ ਜਦੋਂ ਦਾ ਮੇਰੇ ਹੱਥ 'ਚ ਕੈਮਰਾ ਮੈਂ ਆਪਣੇ ਆਪ ਹੀ ਕੈਮਰਾ ਫੋਟੋ ਨਹੀਂ ਕੋਈ ਔਖੀ ਗੱਲ ਨਹੀਂ ਹੈਗੀ ਅਤੇ ਮੈਂ ਆਪਣੇ ਆਪ ਵੀ ਫੋਟੋਗ੍ਰਾਫੀ ਦਾ ਕੰਮ ਆਪੇ ਕੀਤਾ ਆ ਕਿਸੇ ਤੋਂ ਕੋਈ ਮੈਂ ਟ੍ਰੇਨਿੰਗ ਨਹੀਂ ਲਈ ਕਿਸੇ ਨੇ ਮੈਨੂੰ ਕੋਈ ਕੰਮ ਨਹੀਂ ਸਿਖਾਇਆ ਕਿਸੇ ਦਾ ਕੋਈ ਮੈਨੂੰ ਕੰਮ ਸਿਖਾਉਣ ਦਾ ਕੋਈ ਹੱਥ ਨਹੀਂ ਹੈਗਾ ਮੈਂ ਆਪਣੇ ਆਪ ਹੀ ਸਿਖਿਆ ਜਦ ਦਾ ਮੇਰੇ ਕੋਲ ਕੈਮਰਾ ਮੈਂ ਆਪਣੇ ਆਪ ਦਾ ਕੈਮਰਾ ਮੈਂ ਲਿਆ ਆਪਣੀ ਸ਼ੋਪ ਖੋਲ੍ਹੀ ਆ ਮੈਂ ਕੈਮਰਾ ਲਿਆ ਮੈਨੂੰ ਕਿਸੇ ਕੋਈ ਉਹ ਨਹੀਂ ਲਿਆ ਹੈਗਾ ਕਿਸੇ ਦਾ ਕੋਈ ਹੱਥ ਨਹੀਂ ਹੈਗਾ ਮੈਨੂੰ ਕੈਮਰੇ ਕੁਮਰੇ ਦੀ ਸ਼ੋਪ ਖੋਲ੍ਹਣ ਜਾਂ ਮੈਨੂੰ ਇਸ ਕੰਮ ਸਿਖਾਉਣ 'ਤੇ ਮੈਨੂੰ ਕੋਈ ਕਿਸੇ ਦਾ ਹੱਥ ਨਹੀਂ ਹੈਗਾ ਮੈਂ ਆਪਣੇ ਆਪ ਹੀ ਸਾਰਾ ਕੀਤਾ ਹੋਇਆ ਇਹ ਕੰਮ ਮੈਂ ਦੇਖ ਦੇਖ ਕੇ ਹੀ ਸਿੱਖਿਆ ਕਿਸੇ ਕੋਲੋਂ ਨਹੀਂ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਹੈਗਾ ਮੈਂ ਆਪਣੇ ਆਪ ਹੀ ਆਪਣੇ ਦਿਮਾਗ ਨਾਲ ਹੀ ਕੰਮ ਕੀਤਾ ਹੈ ਜੀ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਜੀ